ਹੈਲੋ

ਹੈਲੋ ਹਾਂਜੀ ਅੱਛਾ ਜੀ ਠੀਕ ਹੈ ਮੈਂ ਤਾਂ ਅੱਜ ਮਟਰ ਪਨੀਰ ਪਲੈਨ ਕੀਤਾ ਸੀ ਬਸ ਜੀ ਠੀਕ ਹੈ ਦਾਲ ਹਾਂਜੀ ਮੂੰਗੀ ਮਸਰਾਂ ਦੀ ਵੀ ਹੈ ਚਨੇ ਦੀ ਹੈਗੀ ਆ ਬਾਕੀ ਤੁਸੀਂ ਦੱਸ ਦਓ ਕਿਹੜੀ ਖਾਣੀ ਆ ਉਹ ਹੀ ਬਣਾ ਲਵਾਂਗੇ ਠੀਕ ਹੈ ਚਲੋ ਠੀਕ ਹੈ ਚਲੋ ਠੀਕ ਹੈ ਐਕਸਟਰਾ ਬਣਾ ਲਵਾਂਗੇ ਥੋੜ੍ਹਾ

ਚਲੋ ਕੋਈ ਨਹੀਂ ਨਾਲ ਸਲਾਦ ਸਲੁਦ ਕਰ ਲਵਾਂਗੇ ਨਾ ਫਿਰ ਅੱਛਾ ਲੱਗੇਗਾ

ਹਾਂਜੀ ਹਾਂਜੀ ਜਾਂ ਸੇਵੀਆਂ ਜਾ ਦੇਖ ਲਵਾਂਗੇ ਕੜਾਹ ਦੇਖ ਲਵਾਂਗੇ ਹਾਂ ਡਰਾਈ ਹਾਂ ਡਰਾਈ ਫਰੂਟ ਪਾ ਕੇ ਵਧੀਆ ਬਣਾ ਲਵਾਂਗੇ ਹਾਂਜੀ ਨਹੀਂ ਬਾਹਰੋਂ ਤੁਸੀਂ ਨਾਲ ਦੱਸਿਆ ਕਿ ਹੈਵੀ ਅਤੇ ਖਾਧਾ ਹੀ ਹੋਇਆ ਫਿਰ ਲਾਈਟ ਜਿਹਾ ਦੇਖ ਲਓ ਕੁਛ ਹਾਂਜੀ ਹਾਂਜੀ ਨਾਲ ਸੈ ਸਲਾਦ ਵਗੈਰਾ ਹੋ ਜਾਏਗਾ ਤਾ ਸੋਹਣਾ ਲੱਗੇਗਾ ਵਧੀਆ ਲੱਗੇਗਾ ਹੁੰ ਹੁੰ

ਅੱਛਾ ਅੱਛਾ ਚਲੋ ਕੋਈ ਨਹੀਂ ਤੇ ਕੋਈ ਨਹੀਂ ਤਿਆਰੀ ਮੈਂ ਸ਼ੁਰੂ ਕਰ ਦਿੰਦੀ ਹਾਂ ਹੌਲੀ ਹੌਲੀ ਆਪੇ ਬਣ ਬਣ ਜਾਣਗੀਆਂ ਚੀਜ਼ਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਫੁਲਕੇ ਤਾਂ ਤੁਹਾਡੇ ਆਉਣ 'ਤੇ ਲਾਵਾਂਗੇ ਨਾ ਗਰਮ ਗਰਮ ਹਾਂ ਬਾਕੀ ਰੈਡੀ ਕਰ ਲਵਾਂਗੇ ਸਾਰਾ ਹਾਂਜੀ ਚਲੋ ਠੀਕ ਹੈ ਮੈਡਮ ਠੀਕ ਆ ਓਕੇ